ਹੈਲੋ ਹਾਂਜੀ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਹੋਟਲ ਦੋ ਤਿੰਨ ਵਧੀਆ ਹੈਗੇ ਹੈ ਜੀ ਇੱਕ ਰੋਇਅਲ ਹੈ ਜੀ ਇੱਕ ਆਪਣਾ ਰਾਹੋ ਹੋਟਲ ਹੈ ਹਾਂਜੀ ਨੋਨ ਏਸੀ ਵੀ ਹੈ ਜੀ ਏਸੀ ਵੀ ਹੈ ਜੀ ਖਾਣਾ ਪੀਣਾ ਵਧੀਆ ਹੈ ਜੀ ਫਸਟ ਕਲਾਸ ਹੈ ਹੋਟਲ ਜੀ ਸਾਰੀ ਰਾਤ ਖੁੱਲ੍ਹਾ ਰਹਿੰਦਾ ਜੀ ਹੈਂ ਜੀ ਕਿਆ ਰੈਂਟ ਜੀ ਹਾਂਜੀ ਹਾਂਜੀ ਏ ਸੀ ਦਾ ਜਿਹੜਾ ਹੈ ਦੋ ਹਜ਼ਾਰ ਰੁਪਏ ਹੈ ਜੀ ਅਤੇ ਨੋਨ ਏਸੀ ਲੈਣਾ ਤਾਂ ਉਹ ਹਜ਼ਾਰ ਰੁਪਏ ਦਾ ਹੈ ਜੀ ਹਾਂਜੀ ਹਾਂਜੀ ਵਧੀਆ ਜੀ ਫਸਟ ਕਲਾਸ ਬਾਕੀ ਐਨ ਸਾਫ਼ ਸਫ਼ਾਈ ਵੀ ਠੀਕ ਹੈ ਜੀ ਸਰਵਿਸ ਵੀ ਠੀਕ ਹੈ ਹਾਂਜੀ ਹਾਂਜੀ ਠੀਕ ਸਤਿ ਸ਼੍ਰੀ ਅਕਾਲ